ਭਾਰਤੀ ਪ੍ਰਾਚੀਨ ਅਤੇ ਮੱਧ ਕਾਲੀ ਦੌਰਾਨ ਦੁਆਰੇ ਦੌਰਾਨ ਵਿੱਚ ਕਈ ਰਾਜੇ ਮਸ਼ ਮਸ਼ਹੂਰ ਹਨ ਪਰ ਸਭ ਤੋਂ ਜ਼ਿਆਦਾ ਮ ਵਧੀਆ ਇੱਕ ਰਾਜਾ ਰਣਜੀਤ ਸਿੰਘ ਜੀ ਲੱਗਦੇ ਹਨ ਜਿਹਨਾਂ ਦਾ ਜਨਮ ਸਤਾਰਾਂ ਸੌ ਉਨਤਾਲੀ ਨੂੰ ਹੋਇਆ ਪੰਜਾਬਜ ਉਹਨਾਂ ਨੇ ਪੰਜਾਬ ਨੂੰ ਉ ਸਥਿੱਤੀ ਵਿੱਚ ਸ ਖਾਲਸਾ ਸਮਰਾਜ ਨੂੰ ਉੱਚਾ ਚੁੱਕਣ ਲਈ ਬਹੁਤ ਯਤਨ ਕੀਤੇ ਉਹਨਾਂ ਨੇ ਮੁਗਲਾਂ ਅਤੇ ਅਫ਼ਗਾਨਾਂ ਨਾਲ ਕਈ ਲੜਾਈਆਂ ਲੜੀਆਂ ਅਤੇ ਪੰਜਾਬ ਵਿੱਚ ਖਾਲਸਾ ਰਾਜ ਦੀ ਸਥਾਪਨਾ ਕੀਤੀ ਉਹ ਭਾਵੇਂ ਕਿ ਉਹ ਚੇਚਕ ਦੀ ਬਿਮਾਰੀ ਤੋਂ ਬਚ ਗਏ ਪਰ ਉਹਨਾਂ ਦੀ ਚੇਚਕ ਬਿਮਾਰੀ ਵਿੱਚ ਇੱਕ ਜਾਨ ਇੱਕ ਅੱਖ ਜਾਂਦੀ ਰਹੀ ਅਤੇ ਉਹਦੇ ਬਾਅਦ ਵਿੱਚ ਉਹਨਾਂ ਨੇ ਆਪਣੀਆਂ ਸਾਰੀਆਂ ਮਿਸਲਾਂ ਨੂੰ ਇਕੱਠਾ ਕੀਤਾ ਉਹ ਸੁਕਰਚਾਰੀਆਂ ਮਿਸਲ ਨਾਲ ਸਬੰਧ ਵੀ ਰੱਖਦੇ ਸਨ ਅਤੇ ਉਹਨਾਂ ਦੇ ਉਹਨਾਂ ਦੀ ਮਹਾਰਾਣੀਆਂ ਮਹਾਰਾਜ ਮਹਾਰਾਣੀ ਜਿੰਦਾ ਜਿੰਦਾਂ ਸੀ ਉਹਨਾਂ ਨੇ ਅੰਗਰੇਜ਼ਾਂ ਨਾਲ ਵੀ ਕਈ ਲੜਾਈਆਂ ਲੜੀਆਂ ਅਤੇ ਅਤੇ ਸਿੱਖ ਅੰਗ ਅੰਗਰੇਜ਼ਾਂ ਨੂੰ ਵੀ ਪੰਜਾਬ ਤੋਂ ਬਾਹਰ ਕੱਢਿਆ ਅਤੇ ਉਹਨਾਂ ਦੀ ਮੌ ਮੌਤ ਅਠਾਰਾਂ ਸੌ ਉਨਤਾਲੀ ਨੂੰ ਹੋ ਗਈ